ਹਾਂ ਜੀ ਬਚਪਨ ਵਿੱਚ ਬਹੁਤ ਹੀ ਇਤਿਹਾਸਿਕ ਕਹਾਣੀਆਂ ਸਾਨੂੰ ਸਿੱਖਣ ਨੂੰ ਮਿਲਦੀਆਂ ਸਨ ਇਨ੍ਹਾਂ ਇਤਿਹਾਸਿਕ ਕਹਾਣੀਆਂ ਵਿੱਚੋਂ ਇਹ ਕਹਾਣੀ ਇੱਕ ਹੈ ਜਿਵੇਂ ਕਿ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਵਿੱਚ ਮਨਾਇਆ ਜਾਂਦਾ ਹੈ ਦਸੰਬਰ ਮਹੀਨੇ ਵਿੱਚ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੇਟੇ ਸ਼ਹੀਦ ਹੋ ਸ਼ ਦੋ ਬੇਟੇ ਸ਼ਹੀਦ ਹੋ ਗਏ ਸਨ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ ਉਹਨਾਂ ਦਾ ਸਥਾਨ ਭੋਰਾ ਸਾਹਿਬ ਵਿੱਚ ਸਥਿਤ ਹੈ ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਤਾਂ ਮਾਤਾ ਗੁਜਰੀ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਬੰਦੀ ਬਣਾ ਕੇ ਠੰਡਾ ਠੰਡੇ ਬੁਰਜ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ ਉਹਨਾਂ ਨੂੰ ਖਾਲੀ ਜੰਗਲ ਵਿੱਚ ਸੁੱਟ ਦਿੱਤਾ ਗਿਆ ਸੀ ਉੱਥੇ ਉਨਾਂ ਦੀ ਸ਼ੇਰਾਂ ਨੇ ਰਾਖੀ ਕੀਤੀ ਸੀ ਜਿੱਥੇ ਬਵਾਨਗੜ੍ਹ ਗੁਰਦੁਆਰਾ ਸਥਿਤ ਹੈ ਉਹਨਾਂ ਦੇ ਉਹਨਾਂ ਤੋਂ ਬਾਅਦ ਉਹਨਾਂ ਦਾ ਸੰਸਕਾਰ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ